ਸੈਰ ਸਪਾਟਾ ਤੁਹਾਡੇ ਖੇਤਰ ਜਾਂ ਸਾਡੇ ਖੇਤਰ ਗੱਲ ਤਾਂ ਇੱਕੋ ਜਿਹੀ ਹੋਈ ਹੈ ਹੁਣ ਤਾਂ ਮੈਂ ਆਪਣੇ ਅਨੁਭਵ ਬਾਰੇ ਦੱਸਣਾ ਹੈ ਸੈਟ ਸਪਾਟਾ ਕਰਨ ਨਾਲ ਕੀ ਫਾਇਦਾ ਹੈ ਅਤੇ ਕੀ ਨੁਕਸਾਨ ਹੈ ਸੈਰ ਸਪਾਟਾ ਅਸੀਂ ਕਰਦੇ ਰਹਿੰਦੇ ਹਨ ਜਿਵੇਂ ਕਿ ਪਹਿਲੇ ਅਸੀਂ ਯਾਰਾਂ ਦੋਸਤਾਂ ਨਾਲ ਸੈਰ ਸਪਾਟਾ ਕਰਨ ਜਾਂਦੇ ਹੁੰਦੇ ਸੀ ਸੈਰ ਸਪਾਟਾ ਕਰਨ ਨਾਲ ਸਾਡਾ ਰੁਜ਼ਗਾਰ ਦੇ ਮੌਕਿਆਂ ਵਿੱਚ ਕੋਈ ਫਰਕ ਨਹੀਂ ਪਿਆ ਇਸ ਨਾਲ ਇੱਕ ਇਹ ਨੁਕਸਾਨ ਹੈ ਰੁਜ਼ਗਾਰ ਤਾਂ ਇਹਨਾਂ ਮਿਲਦਾ ਨਹੀਂ ਸੈਰ ਸਪਾਟਾ ਸਾਨੂੰ ਅਤੇ ਸਾਡੀ ਇਹ ਦੋਸਤਾਂ ਵਗੈਰਾ ਦੇ ਨਾਲ ਘੁੰਮਣ ਦਾ ਫਾਇਦਾ ਆਨੰਦ ਪ੍ਰਾਪਤ ਹੁੰਦਾ ਹੈ ਸੈਰ ਸਪਾਟਾ ਕਰਨ ਵੇਲੇ ਕੁਛ ਐਸੇ ਲੋਕ ਮਿਲ ਜਾਂਦੇ ਹਨ ਜੋ ਕਿ ਸਾਨੂੰ ਰੁਜ਼ਗਾਰ ਵਗੈਰਾ ਦੱਸਦੇ ਹਨ ਜੋ ਕਿ ਸਾਨੂੰ ਕਈ ਕੰਪਨੀ ਵਗੈਰਾ 'ਚ ਲੱਗਿਆ ਤਾਂ ਉਹ ਸਾਨੂੰ ਕੰਮ ਵਗੈਰਾ ਦੱਸਦੇ ਹੈ ਤੁਸੀਂ ਵੀ ਇਹ ਕੰਮ ਕਰੋ ਤੁਹਾਨੂੰ ਵੀ ਇਹ ਪ੍ਰੋਫਿਟ ਹੋਵੇਗਾ ਪਰ ਅਸੀਂ ਉਹਨਾਂ ਨੂੰ ਗੱਲ ਚੰਗੀ ਤਰ੍ਹਾਂ ਨਹੀਂ ਸੁਣਦੇ ਅਤੇ ਇਹ ਸਾਡੀ ਜ਼ਿੰਦਗੀ ਦਾ ਨੁਕਸਾਨ ਹੋ ਜਾਂਦੇ ਹੈ ਸੈਟ ਸਪਾਟੇ ਨਾਲ ਹੀ ਕਈਆਂ ਨੁਕਸਾਨ ਹੁੰਦੇ ਆ ਕਈ ਫਾਇਦੇ ਹੁੰਦੇ ਆ ਅਤੇ ਕਈ ਦੋ ਤਰ੍ਹਾਂ ਦੇ ਹੁੰਦੇ ਆ ਨੁਕਸਾਨ ਅਤੇ ਫਾਇਦਾ ਕਈ ਲੋਕ ਆਪਣਾ ਨੁਕਸਾਨ ਕਰਾ ਲੈਣ ਅਤੇ ਕਈ ਲੋਕ ਆਪਣਾ ਫਾਇਦਾ ਕਰਾ ਲੈਂਦੇ ਆ ਸਾਨੂੰ ਘੱਟੋ ਘੱਟ ਆਪਣਾ ਆਪਣੀ ਜ਼ਿੰਦਗੀ ਵਿੱਚ ਸੈਰ ਸਪਾਟਾ ਕਰਨ ਵੇਲੇ ਆਪਣਾ ਫਾਇਦਾ ਲੱਭਣਾ ਚਾਹੀਦਾ ਹੈ ਫਾਇਦਾ ਲੱਭਣ ਦੇ ਨਾਲ ਨਾਲ ਸਾਡੀ ਰੁਜ਼ਗਾਰ ਵਧਦੀ ਹੈ ਅਤੇ ਘਰ ਘੱਟ ਤੋਂ ਘੱਟ ਜਦੋਂ ਅਸੀਂ ਚਾਰ ਪੰਜ ਦੋਸਤਾਂ ਨਾਲ ਬਾਹਰ ਸੈਰ ਸਪਾਟੇ ਕਰਨ ਨਿਕਲਦੇ ਹਨ ਕੋਈ ਨਾ ਕੋਈ ਇਨਸਾਨ ਮਿਲ ਜਾਂਦਾ ਹੈ ਜੋ ਆਪਣੀ ਦਿਮਾਗ ਦੀ ਗੱਲ ਦੱਸਦਾ ਹੈ ਅਤੇ ਆਪਣੇ ਬਾਰੇ ਸ ਦੱਸਦਾ ਹੈ ਕਿ ਉਹ ਕਿੱਦਾਂ ਆਪਣਾ ਰੁਜ਼ਗਾਰ ਚਲਾ ਰਿਹਾ ਰੁਜ਼ਗਾਰ ਦੇ ਨਾਲ ਨਾਲ ਹੀ ਸਾਡੀ ਫੈਮਲੀ ਇਸ਼ੂਜ ਦੂਰ ਹੁੰਦੇ ਹਨ ਜਦ ਹਰ ਇੱਕ ਬੰਦੇ ਕੋਲ ਰੁਜ਼ਗਾਰ ਹੋਵੇਗਾ ਤਾਂ ਪਰਿਵਾਰਿਕ ਸੁੱਖ ਮਿਲੇਗਾ ਪਰਿਵਾਰਿਕ ਸੁੱਖ ਦੇ ਨਾਲ ਨਾਲ ਉਹੀ ਇਨਸਾਨ ਸਫਲ ਹੋਵੇਗਾ ਜਿਹਦੇ ਕੋਲ ਆਪਣੀ ਨੌਕਰੀ ਹੋਵੇਗੀ ਸੈਰ ਸਪਾਟਾ ਸਾਡੇ ਲਈ ਕਾਫੀ ਹੱਦ ਤੱਕ ਨੁਕਸਾਨ ਦਾਇਕ ਹੋਵੇਗਾ ਇਸੇ ਕਾਰਨ ਅਸੀਂ ਦੇਖਦੇ ਹਾਂ ਕਿ ਸਾਨੂੰ ਸੈਰ ਸਪਾਟਾ ਦ ਅਤੇ ਇੱਕ ਫਾਇਦਾ ਮਿਲਦਾ ਅਤੇ ਇੱਕ ਨੁਕਸਾਨ ਵੀ ਜੋ ਦੋਨਾਂ ਵਿੱਚੋਂ ਇੱਕ ਰਸਤਾ ਚੁਣਦਾ ਹੈ ਉਹ ਕਿਤੇ ਨਾ ਕਿਤੇ ਜੋ ਕੋਈ ਨਾਦ ਉਹ ਤਾਂ ਭਟਕ ਜਾਂਦਾ ਜਿਹੜਾ ਹਾਂ ਤਾਂ ਚੁਣਦਾ ਅਤੇ ਉਹ ਸਫਲ ਹੋ ਜਾਂਦਾ ਹੈ ਧੰਨਵਾਦ